ਪੰਜਾਬ ਵਿੱਚ ਖੇਤੀਬਾੜੀ ਲਈ ਸਭ ਤੋਂ ਉੱਤਮ ਮਿੱਟੀ ਦੀ ਕਿਸਮ ਕੀ ਹੈ ਪੰਜਾਬ ਵਿੱਚ ਖੇਤੀਬਾੜੀ ਲਈ ਸਭ ਤੋਂ ਉੱਤਮ ਮਿੱਟੀ ਕਾਲੀ ਮਿੱਟੀ ਦੀ ਹੈ ਕਾਲੀ ਮਿੱਟੀ ਹੈ ਜੋ ਕਪਾਹ ਅਤੇ ਦਲਹਨੀ ਫਸਲਾਂ ਲਈ ਚੰਗੀ ਹੈ ਇਹ ਮਿੱਟੀ ਨਮੀ ਨੂੰ ਸੰਭਾਲ ਕੇ ਰੱਖਦੀ ਹੈ ਜੋ ਫਸਲਾਂ ਲਈ ਲਾਭਦਾਇਕ ਹੈ ਇਹ ਮਿੱਟੀ ਜੀਵਨ ਕਾਰਕ ਪਦਾਰਥਾਂ ਨਾਲ ਭਰਪੂਰ ਹੁੰਦੀ ਹੈ ਜਿਸ ਨਾਲ ਫਸਲਾਂ ਵਧੀਆ ਤਰੀਕੇ ਨਾਲ ਵੱਧਦੀਆਂ ਹਨ ਸਬਜ਼ੀਆਂ ਅਤੇ ਫਸਲਾਂ ਵਰਗੀਆਂ ਫਸਲਾਂ ਲਈ ਇਹ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਵੱਧ ਪਾਣੀ ਵੀ ਜਲਦੀ ਨਿਕਲ ਜਾਂਦਾ ਹੈ ਜਿਸ ਨਾਲ ਜਲ ਪ੍ਰਵਾਹ ਨਹੀਂ ਹੁੰਦਾ ਪੰਜਾਬ ਵਿੱਚ ਖੇਤੀਬਾੜੀ ਲਈ ਸਭ ਤੋਂ ਉੱਤਮ ਮਿੱਟੀ ਦੋਮਨ ਦੋਪਟ ਨ ਮਿੱਟੀ ਹੈ ਸਬਜ਼ੀਆਂ ਅਤੇ ਮੂੰਗਫਲੀਆਂ ਵਰਗੀਆਂ ਫਸਲਾਂ ਲਈ ਠੀਕ ਹੈ ਪੰਜਾਬ ਵਿੱਚ ਖ਼ਾਸ ਤੌਰ 'ਤੇ ਦੋਮਨ ਮਿੱਟੀ ਨੂੰ ਖੇਤੀਬਾੜੀ ਲਈ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਸਬਜ਼ੀਆਂ ਅਤੇ ਫਸਲਾਂ ਲਈ ਇਹ ਮਿੱਟੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ